ਹੈਲੋ ਹਾਂਜੀ ਤੁਸੀਂ ਪਾਲ ਜੀ ਕੈਟਰਿੰਗ ਤੋਂ ਬੋਲ ਰਹੇ ਓਂ ਹਾਂਜੀ ਹਾਂਜੀ ਮੈਂ ਨਾ ਸਾਡੇ ਨਾ ਇੱਕ ਮਤਲਬ ਮੈਰਿਜ ਹੈ ਅਤੇ ਤੁਹਾਨੂੰ ਡੇਟ ਦੱਸ ਦਿਆਂ ਡੇਟ ਫਿਕਸ ਹੋ ਗਈ ਹੈ ਦਸ ਤਾਰੀਖ ਦੀ ਹੈ ਹਾਂਜੀ ਦਸ ਦਸੰਬਰ ਦੀ ਜੀ ਦਸ ਦਸੰਬਰ ਹਾਂਜੀ ਹਾਂਜੀ ਹਾਂਜੀ ਹਾਂਜੀ ਉਹਦੇ ਵਿੱਚ ਆਪਾਂ ਨੇ ਲਗਭਗ ਹਰ ਤਰ੍ਹਾਂ ਦੀਆਂ ਆਈਟਮਾਂ ਤਿਆਰ ਕਰਨੀਆਂ ਵੈਜ ਨੌਨ ਵੈਜ ਹਾਂਜੀ ਤੁਹਾਡੇ ਕੋਲ ਕੈਟਰਿੰਗ ਵਾਲੇ ਯਾਰ ਵੇਟਰ ਵਗੈਰਾ ਸਾਰਾ ਪ੍ਰਬੰਧ ਹੈਗਾ ਹਾਂਜੀ ਹਾਂਜੀ ਅਤੇ ਲਗਭਗ ਤਿੰਨ ਸੌ ਬੰਦੇ ਦਾ ਸਮਾਨ ਤਿਆਰ ਕਰਨਾ ਹੁਣ ਤੁਸੀਂ ਦੱਸੋ ਕਿਵੇਂ ਤਿਆਰ ਕਰੋਗੇ ਦੇਖ ਲਓ ਅਸੀਂ ਕਹਿੰਦੇ ਹਾਂ ਵੀ ਅਸੀਂ ਪਰ ਪਲੇਟ ਪਰ ਹੈੱਡ ਬੰਦਾ ਕਰ ਲਈਏ ਤਿੰਨ ਸੌ ਬੰਦੇ ਦਾ ਦੇਖੋ ਹਾਂਜੀ ਹਾਂਜੀ ਬਿਲਕੁਲ ਠੀਕ ਹੈ ਦੇਖੋ ਅਸੀਂ ਸਵੇਰੇ ਤਾਂ ਕਹਿੰਦੇ ਹਾਂ ਵੀ ਉਹਦੇ ਵਿੱਚ ਜਿਵੇਂ ਸਾਰਾ ਕੁਝ ਜੂਸ ਵਗੈਰਾ ਕੋਲ ਡਰਿੰਕ ਵਗੈਰਾ ਨਾ ਪੂਰਾ ਦਿਨ ਚੱਲੇ ਠੀਕ ਆ ਕੋਲ ਡਰਿੰਕ ਅਤੇ ਨਾਲ ਕੋਈ ਸਵੇਰੇ ਦੀ ਕੋਈ ਨਾਲ ਨਾ ਨਮਕੀਨ ਆਈਟਮ ਕਰ ਦਿਓ ਹਾਂਜੀ ਹਾਂਜੀ ਸ਼ੇਕ ਐਡ ਕਰ ਲਓ ਜੀ ਹਾਂਜੀ ਹਾਂਜੀ ਬਿਲਕੁਲ ਅਤੇ ਉਸ ਤੋਂ ਬਾਅਦ ਦੁਪਹਿਰ ਨੂੰ ਦੇਖੋ ਚਾਹ ਪਾਣੀ ਨਾਲ ਕੁਝ ਹੋ ਜਵੇ ਜਿਵੇਂ ਫਿਸ਼ ਵਗੈਰਾ ਵੀ ਲੈਂਦੇ ਆ ਬੰਦੇ ਹੈ ਨਾ ਨੌਨ ਵੈੱਜ ਵੀ ਹੋ ਜਵੇ ਸਨੈਕਸ ਵੀ ਤੁਸੀਂ ਆਪਣੇ ਵੱਲੋਂ ਦੱਸੋ ਤੁਸੀਂ ਐਡਵਾਈਜ ਕਰੋ ਵੀ ਕੀ ਕੀ ਦਈਏ ਤੁਸੀਂ ਕੀ ਦੋਗੇ ਹਾਂਜੀ ਹਾਂਜੀ ਤੁਸੀਂ ਦੋ ਇਹਨਾਂ ਵਿੱਚੋਂ ਦੋ ਆਈਟਮਾਂ ਕਰ ਦਿਓ ਜਿਹੜੀਆਂ ਵੀ ਸਹੀ ਬੈਠਦੀਆਂ ਦੋ ਦੋ ਦੋ ਦੋ ਸਟੋਲ ਤੁਸੀਂ ਸਲੈਕਟ ਕਰ ਲਓ ਕੋਈ ਡੋਸੇ ਅਤੇ ਤੁਸੀਂ ਡੋਸੇ ਡੋਸਾ ਨੂੰ ਕੱਟ ਦੋ ਨਿਊਡਲ ਅਤੇ ਇਹ ਗੋਲਗੱਪੇ ਲਾ ਦੋ ਟਿੱਕੀ ਲਾ ਦੋ ਨਾਲ ਠੀਕ ਹੈ ਅਤੇ ਬਾਕੀ ਤੁਸੀਂ ਆਪਣਾ ਬੇਟਰ ਵਗੈਰਾ ਦੇਖ ਲਓ ਵੀ ਉਹਨਾਂ ਦੇ ਵਧੀਆ ਡਰੈਸ ਪਾਈ ਹੋਵੇ ਸਾਫ ਸੁਥਰੀ ਪਾਈ ਹੋਵੇ ਠੀਕ ਆ ਠੀਕ ਆ ਜੀ ਉਹਨਾਂ ਉਹਨਾਂ ਦੀ ਕੀ ਵੈਸੇ ਹੋਵੇਗਾ ਪਾ ਡੇ ਦਿਹਾੜੀ ਕੀ ਰੇਟ ਲੈਦੇ ਤੁਸੀਂ ਉਹ ਉਹ ਉਹ ਪਤਾ ਕੀ ਆ ਬਦ ਮਤਲਬ ਆਪਾਂ ਹਰ ਚੀਜ਼ ਵਧੀਆ ਹੀ ਕਰਵਾਉਣੀ ਆ ਹਰ ਐਟਮ ਮਤਲਬ ਪੂਰੀ ਟੋਪ ਦੀ ਹੋਵੇ ਮਤਲਬ ਜਿਹੜੀ ਸ਼ਾਮ ਨੂੰ ਲੰਚ ਟਾਈਮ ਦਿੰਦੇ ਆ ਕੋਈ ਵੀ ਮਤਲਬ ਪੈਸੇ ਵਾਲੀ ਕੋਈ ਉਹ ਨਹੀਂ ਵੀ ਤੁਹਾਨੂੰ ਤੁਸੀਂ ਸਾਰੀ ਸਰਵਿਸ ਵਧੀਆ ਦੇਣੀ ਠੀਕ ਆ ਠੀਕ ਓਕੇ ਠੀਕ ਆ ਠੀਕ ਆ ਠੀਕ ਆ ਠੀਕ ਆ ਠੀਕ ਆ ਅਤੇ ਕੋਈ ਬਾਕੀ ਨਹੀਂ ਕੋਈ ਮੌਕੇ 'ਤੇ ਬਾਕੀ ਕੁਝ ਤੁਹਾਨੂੰ ਅਸੀਂ ਦੇਣਾ ਆਵਾਂਗੇ ਸਾਈ ਮੌਕੇ 'ਤੇ ਡਿਸਕਾਊਂਟ ਕਰਦੇ ਜੋ ਕੁਝ ਹੋਵੇਗਾ ਠੀਕ ਆ ਹਾਂਜੀ ਓਕੇ ਹਾਂਜੀ ਅੱਛਾ ਜੀ ਤੁਸੀਂ ਤੁਹਾਡੇ ਕੋਲ ਅਸੀਂ ਕੱਲ੍ਹ ਨੂੰ ਪਹੁੰਚ ਰਹੇ ਤੁਹਾਡੇ ਔਫਿਸ ਠੀਕ ਓਕੇ ਓਕੇ